ਸਤਿ ਸ਼੍ਰੀ ਅਕਾਲ ਸਰ ਮੈਂ ਹਰਪ੍ਰੀਤ ਕੌਰ ਬੋਲ ਰਹੀ ਹਾਂ ਕੱਲ੍ਹ ਨਾ ਮੈਂ ਤੁਹਾਡੀ ਟਰੈਵਲ ਏਜੰਸੀ 'ਚ ਫ਼ੋਨ ਕੀਤਾ ਸੀ ਇੱਕ ਨਾ ਬਸ ਕੀਤੀ ਸੀ ਅਸੀਂ ਅਸੀਂ ਯਾਤਰਾ 'ਤੇ ਜਾਣਾ ਸੰਗਤ ਨਾਲ ਅਨੰਦਪੁਰ ਸਾਹਿਬ ਜਾਣਾ ਹੈ ਕੀਰਤਪੁਰ ਸਹਿਬ ਨੈਣਾ ਦੇਵੀ ਜਾਣਾ ਹੁਣ ਸਾਰੀਆਂ ਸੰਗਤਾਂ ਨਾ ਤਿਆਰ ਹੋ ਕੇ ਰੋਡ 'ਤੇ ਖੜੀਆਂ ਹੈ ਕੀ ਤੁਹਾਡਾ ਡਰਾਈਵਰ ਜਲਦੀ ਆ ਰਿਹਾ ਹੈ ਜੇ ਨਹੀਂ ਜਲਦੀ ਆ ਰਿਹਾ ਤਾਂ ਤੁਹਾਡੇ ਅੱਗੇ ਰਿਕਵੈਸਟ ਆ ਹੱਥ ਜੋੜ ਕੇ ਉਹਨੂੰ ਟਾਈਮ ਨਾਲ ਭੇਜ ਦਿਓ ਤਾਂ ਕਿ ਅਸੀਂ ਟਾਈਮ ਨਾਲ ਸਾਰੇ ਪਾਸੇ ਘੁੰਮ ਸਕੀਏ ਅਰਾਮ ਨਾਲ ਮੱਥਾ ਟੇਕ ਸਕੀਏ ਔਰ ਬੱਚੇ ਹੈ ਨਾਲ ਕੋਈ ਵੀ ਬੱਚੇ ਜਾਂ ਸੰਗਤ ਅਸੀਂ ਕੋਈ ਵੀ ਪਰੇਸ਼ਾਨ ਨਾ ਹੋ ਸਕੀਏ ਟਾਈਮ ਨਾਲ ਅਸੀਂ ਜਾਵਾਂਗੇ ਘਰੋਂ ਤਾਂ ਹੀ ਫੇਰ ਟਾਈਮ ਨਾਲ ਘਰ ਵਾਪਿਸ ਆਵਾਂਗੇ ਇਸ ਕਰਕੇ ਸਰ ਰਿਕਵੈਸਟ ਹੈ ਤੁਸੀਂ ਆਪਣੇ ਡਰਾਈਵਰ ਨੂੰ ਨਾ ਟਾਈਮ ਨਾਲ ਪ ਭੇਜ ਦਿਓ ਸਾਡੇ ਕੋਲ ਤਾਂ ਕਿ ਅਸੀਂ ਟਾਈਮ ਨਾਲ ਘਰ ਤੋਂ ਨਿਕਲ ਸਕੀਏ